ਪੰਜਾਬ ਦੀ ਆਰਥਿਕਤਾ ਵਿੱਚ ਅਜੇ ਵੀ ਕਲਾ ਦਾ ਪ੍ਰਦਰਸ਼ਨ ਕਾਫ਼ੀ ਜ਼ਿਆਦਾ ਹੈ ਅਗਰ ਅਸੀਂ ਅੱਜ ਵੀ ਸੈਰ ਸਪਾਟੇ 'ਤੇ ਨਿਕਲ ਜਾਈਏ ਤਾਂ ਸਾਨੂੰ ਕਿਤੇ ਨਾ ਕਿਤੇ ਇਸ ਕਲਾ ਦਾ ਪ੍ਰਦਰਸ਼ਨ ਜ਼ਰੂਰ ਦਿਖੇਗਾ ਜਿੱਦਾਂ ਕਿ ਪਟਿਆਲੇ ਵਿੱਚ ਹੀ ਬਾਈ ਨੰਬਰ ਅਤੇ ਇੱਕੀ ਨੰਬਰ ਪੁੱਲ ਜੋ ਹੈ ਉਹਨਾਂ ਨੂੰ ਕਾਫ਼ੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਉਹਨਾਂ ਉੱਤੇ ਪੰਜਾਬ ਦੇ ਸੱਭਿਆਚਾਰ ਬਾਰੇ ਕਲਾਕ੍ਰਿਤੀ ਕੀਤੀ ਗਈ ਹੈ ਉਸ ਕਲਾਕ੍ਰਿਤੀ ਵਿੱਚ ਊੜਾ ਐੜਾ ਲਿਖਿਆ ਗਿਆ ਹੈ ਚਰਖਾ ਕੱਤਦੀਆਂ ਬੀਬੀਆਂ ਦਿਖਾਈਆਂ ਗਈਆਂ ਹਨ ਅਤੇ ਬਹੁਤ ਐਸੀਆਂ ਚੀਜ਼ਾਂ ਦਿਖਾਈਆਂ ਗਈਆਂ ਹਨ ਜੋ ਕਿ ਪੰਜਾਬ ਦਾ ਸੱਭਿਆਚਾਰ ਹਨ ਅਤੇ ਉਹ ਪਹਿਲਾਂ ਦੇ ਸਮੇਂ ਵਿੱਚ ਪਿੰਡਾਂ ਵਿੱਚ ਹੋਇਆ ਕਰਦੀ ਸੀ ਅੱਜ ਵੀ ਅਗਰ ਅਸੀਂ ਪਿੰਡਾਂ ਵਿੱਚ ਚਲੇ ਜਾਈਏ ਤਾਂ ਉਹਨਾਂ ਕਾਫ਼ੀ ਘਰਾਂ ਦੀ ਕੰਧਾਂ ਉੱਤੇ ਵੀ ਸਾਨੂੰ ਇਹ ਕਲਾਕ੍ਰਿਤੀ ਦੇਖਣ ਨੂੰ ਮਿਲਦੀ ਹੈ ਅੱਜ ਕੁਝ ਰੈਸਟੋਰੈਂਟ ਅਤੇ ਢਾਬੇ ਵੀ ਅੱਜ ਕੱਲ੍ਹ ਇਸ ਉੱਤੇ ਇਸ ਥੀਮ ਨੂੰ ਲੈ ਕੇ ਬਣਾਏ ਜਾ ਰਹੇ ਹਨ ਜਿੱਦਾਂ ਕਿ ਜਲੰਧਰ ਸ਼ਹਿਰ ਵਿੱਚ ਹਵੇਲੀ ਉਹ ਸਾਰਾ ਪੰਜਾਬ ਦਾ ਪੁਰਾਣਾ ਸੱਭਿਆਚਾਰ ਅਤੇ ਕਲਾਕ੍ਰਿਤੀਆਂ ਦਰਸ਼ਾਉਂਦੀ ਹੈ ਕਾਫ਼ੀ ਮਿਊਜ਼ੀਅਮਾਂ ਵਿੱਚ ਵੀ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਗਈਆਂ ਹਨ ਤਾਂ ਕਿ ਸਾਨੂੰ ਪੰਜਾਬ ਦੀ ਇਹ ਅ ਸ਼ਿਲਪਾ ਕ੍ਰਿਤੀ ਦਾ ਵਰਨਣ ਹੋਵੇ